ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਤੁਸੀਂ ਕਿੱਥੇ ਆਪਣਾ ਮਤਲਬ ਮਕਾਨ ਲੈਣਾ ਚਾਹੁੰਦੇ ਹੋ ਇੱਧਰ ਇੱਕ ਟੀਚਰ ਕਨੋਲੀ ਆ ਉਹਦੇ ਵਿੱਚ ਵਧੀਆ ਵੀ ਆਈ ਪੀ ਬੰਦੇ ਟੀਚਰ ਰਹਿੰਦੇ ਆ ਚੰਗੇ ਬੰਦੇ ਰਹਿੰਦੇ ਆ ਅਤੇ ਉੱਧਰ ਆਪਾਂ ਨੂੰ ਕੋਠੀ ਮਿਲਜੂਗੀ ਇੱਕ ਤੁਸੀਂ ਲੈਣੀ ਆ ਤੁਸੀਂ ਰੈਂਟ 'ਤੇ ਲੈਣੀ ਆ ਜਾਂ ਤੁਸੀਂ ਆਪਣੀ ਕੋਠੀ ਲੈਣੀ ਆ ਹਾਂਜੀ ਉਹ ਆਪਾਂ ਨੂੰ ਦਸ ਤੋਂ ਬਾਰਾਂ ਲੱਖ ਦੇ ਵਿੱਚ ਮੰਨ ਲਓ ਕੋਠੀ ਮਿਲ ਜਾਊਗੀ ਕੋਠੀ ਦੇ ਵਿੱਚ ਤਿੰਨ ਕਮਰੇ ਆ ਜੀ ਇੱਕ ਡਰਾਇੰਗ ਰੂਮ ਲੈਟਰਿੰਗ ਬਾਥਰੂਮ ਅਟੈਚ ਆ ਕਿਚਨ ਹੈ ਜੀ ਅਤੇ ਅੱਗੇ ਗਾਰਡਨ ਵਗੈਰਾ ਬਣਿਆ ਹੋਇਆ ਹੈਗਾ ਹਾਂਜੀ ਹਾਂਜੀ ਹਾਂਜੀ ਜੇ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਤਾਂ ਰੈਂਟ 'ਤੇ ਵੀ ਆਪਣੇ ਕੋਲ ਇੱਕ ਮਕਾਨ ਹੈਗਾ ਅਤੇ ਉਹਦਾ ਕੋਈ ਦਸ ਕੁ ਹਜ਼ਾ ਦਸ ਕੁ ਹਜ਼ਾਰ ਰੁਪਇਆ ਉਹਦਾ ਕੋਈ ਖਰਚਾ ਹੋਊਗਾ ਅਤੇ ਉਹਦੇ ਵਿੱਚ ਵੀ ਦੋ ਕਮਰੇ ਹੈਗੇ ਆ ਡਰਾਇੰਗ ਰੂਮ ਹੈਗਾ ਲੋਬੀ ਹੈਗੀ ਆ ਮਤਲਬ ਕਿਚਨ ਹੈਗਾ ਅਤੇ ਲੈਟਰਿੰਗ ਬਾਥਰੂਮ ਉਹਦੇ ਨਾਲ ਵੀ ਅਟੈਚ ਹੈਗਾ ਪਰ ਉਹਦੇ ਸਾਹਮਣੇ ਕੋਈ ਗਾਰਡਨ ਵਗੈਰਾ ਹੈ ਨਹੀਂ ਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਫਿਰ ਵੀ ਤੁਸੀਂ ਕੋਈ ਵੱਧ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬ੍ਰਦਰ ਨੂੰ ਲੈ ਕੇ ਅਤੇ ਸਾਡੇ ਦਫਤਰ ਆ ਜਾਣਾ ਤੁਹਾਨੂੰ ਬਿਹਤਰ ਜਾਣਕਾਰੀ ਮਿਲਜੂਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਜੋ ਵੀ ਇਨਫੋਰਮੇਸ਼ਨ ਮੇਰੇ ਕੋਲ ਹੋਊਗੀ ਮੈਂ ਸਾਰੀ ਤੁਹਾਨੂੰ ਸੈਂਡ ਕਰਦਾਂਗਾ ਤੁਹਾਡੇ ਬ੍ਰਦਰ ਨੂੰ ਸੈਂਡ ਕਰਦਾਂਗਾ ਹਾਂਜੀ ਹਾਂਜੀ ਇੱਕ ਵਾਰੀ ਤਾਂ ਆਪਣੇ ਕੋਲ ਇਹ ਹੀ ਦੋ ਕੋਠੀਆਂ ਉਪਲੱਬਧ ਸੀਗੀਆਂ ਇੱਕ ਰੈਂਟ 'ਤੇ ਮੰਨ ਲਓ ਇੱਕ ਜੇ ਤੁਸੀਂ ਆਪਣੀ ਖਰੀਦਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਮਿਲ ਜਾਊਗੀ ਉਹਦਾ ਰੇਟ ਤੁਹਾਨੂੰ ਦੱਸ ਹੀ ਚੁੱਕਿਆ ਮੈਂ ਤਾਂ ਬਕਾਇਦਾ ਜੇ ਹੋਰ ਵੀ ਬਿਹਤਰ ਜਾਣਕਾਰੀਆਂ ਲੈਣੀਆਂ ਤੁਸੀਂ ਆਪਣੇ ਬ੍ਰਦਰ ਨੂੰ ਲੈ ਕੇ ਸਾਡੇ ਆਫਿਸ ਆ ਜਾਇਓ ਅਤੇ ਆਪਾਂ ਬੈਠ ਕੇ ਗੱਲ ਕਰ ਲਾਂਗੇ ਓਕੇ ਜੀ ਧੰਨਵਾਦ